ਸਾਡਾ ਰਾਜ ਪੰਜਾਬ ਹੈ ਅਤੇ ਪੰਜਾਬ ਵਿੱਚ ਹਾਲਾਂਕਿ ਸਾਰੇ ਧਰਮਾਂ ਦੇ ਆਗੂਆਂ ਦਾ ਸਨਮਾਨ ਕੀਤਾ ਜਾਂਦਾ ਹੈ ਪਰ ਪੰਜਾਬ ਵਿੱਚ ਕਿਉਂਕਿ ਜ਼ਿਆਦਾ ਸੰਖਿਆ ਵਿੱਚ ਸਿੱਖੀ ਨੂੰ ਮੰਨਣ ਵਾਲੇ ਜੋ ਰਹਿੰਦੇ ਹਨ ਅਤੇ ਅਸੀਂ ਗੁਰਦੁਆਰੇ ਦੇ ਗ੍ਰੰਥੀ ਸਾਹਿਬ ਨੂੰ ਜ਼ਿਆਦਾ ਸਨਮਾਨ ਦੀ ਦ੍ਰਿਸ਼ਟੀ ਨਾਲ ਦੇਖਦੇ ਹਾਂ ਅਤੇ ਜੋ ਗੁਰੂ ਸਾਹਿਬ ਹੋਏ ਨੇ ਜਾਂ ਹੋਰ ਵੀ ਸੰਤ ਪਰੰ ਪਰੰਪਰਾ ਹੈ ਜੋ ਸਿੱਖੀ ਦਾ ਪ੍ਰਚਾਰ ਕਰਦੇ ਹਨ ਜਿਵੇਂ ਸੰਤ ਈਸ਼ਰ ਸਿੰਘ ਜੀ ਅਤੇ ਸੰਤ ਮਸਕੀਨ ਜੀ ਅਸੀਂ ਇਹਨਾਂ ਦਾ ਬਹੁਤ ਆਦਰ ਕਰਦੇ ਹਾਂ ਕਾਰਨ ਕਿ ਜਿਊਣ ਜਿਊਣ ਵਾਸਤੇ ਜੋ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਕਿ ਕਿਰਤ ਕਰੋ ਵੰਡ ਛਕੋ ਨਾਮ ਜਪੋ ਜੋ ਇਹਨਾਂ ਸਿਧਾਂਤਾਂ ਨੂੰ ਜਨ ਜਨ ਤੱਕ ਲੈ ਕੇ ਜਾਂਦੇ ਨੇ ਅਤੇ ਇਸ ਦਾ ਪ੍ਰਚਾਰ ਕਰਦੇ ਨੇ ਅਤੇ ਉਹ ਇਹ ਪੱਕੀ ਗੱਲ ਹੈ ਕਿ ਉਹ ਸਨਮਾਨ ਪਾਉਣਗੇ ਹੀ ਪਾਉਣਗੇ ਕਿਉਂਕਿ ਸਮਾਜ ਵਿੱਚ ਜੋ ਜਾਤੀਵਾਦ ਹੈ ਊਚ ਨੀਚ ਹੈ ਮਹਾਂ ਪੁਰਸ਼ਾਂ ਦੇ ਉਪਦੇਸ਼ਾਂ ਦੇ ਕਰਕੇ ਇਹ ਕੁਰੀਤੀਆਂ ਦਾ ਵਿਨਾਸ਼ ਹੁੰਦਾ ਹੈ ਅਤੇ ਅਸੀਂ ਇਹਨਾਂ ਸੰਸਕਾਰਾਂ ਨੂੰ ਇਹਨਾਂ ਸੰਤਾਂ ਦੇ ਮਾਧਿਅਮ ਨਾਲ ਸਿੱਖਦੇ ਹਾਂ ਜੋ ਕਿ ਸਾਡੇ ਜੀਵਨ 'ਚ ਕੰਮ ਆਉਂਦੇ ਹਨ ਧੰਨਵਾਦ